ਕੁਸ਼ਾਣ ਕੁਸ਼ਾਣ ਵੰਸ਼ ਤੋਂ ਬਾਅਦ ਗੁਪਤ ਵੰਸ਼ ਪੰਜਾਬ ਵਿੱਚ ਆਇਆ ਸੀ ਨਾ ਜਿਹੜਾ ਕਿ ਉੱਤਰੀ ਭਾਰਤ ਦਾ ਇੱਕ ਰਾਜਾ ਸੀ ਸੰਸਥਾਪਕ ਇਸਦਾ ਸ੍ਰੀ ਗੁਪਤ ਸੀ ਅਤੇ ਇਹਦਾ ਜਿਹੜਾ ਸਭ ਤੋਂ ਮਹੱਤਵਪੂਰਨ ਰਾਜਾ ਹੈਗਾ ਤਾ ਚੰਦਰਗੁਪਤ ਮੌਰੀਆ ਸੀ ਅਤੇ ਆ ਆਹਾ ਆਇਆ ਤਾ ਤਿੰਨ ਸੌ ਉੱਨੀ ਈ ਡੀ ਵਿੱਚ ਆਪਣਾ ਪੰਜਾਬ ਵਿੱਚ ਆਇਆ ਸੀ ਇਹਦੇ ਮਗ ਇਸਦੇ ਪਿੱਛੇ ਪਿੱਛੇ ਹੀ ਇਹਦਾ ਪੁੱਤਰ ਸਮੁੰਦਰ ਗੁਪਤ ਆ ਗਿਆ ਤਾ ਇਹਨੇ ਯੂਪਾ ਕਿਸਮ ਦੇ ਸੋਨੇ ਦੇ ਸਿੱਕੇ ਚਲਾਏ ਸੀ ਪੰਜਾਬ ਦੇ ਵਿੱਚ ਅਤੇ ਇਸ ਲਈ ਲੁਧਿਆਣਾ ਲੁਧਿਆਣਾ ਅਤੇ ਸਨੇਤ ਦੇ ਜਿਹੜਾ ਪਿੰਡ ਹੈਗਾ ਉਹਦੇ ਕਈ ਥਾਵਾਂ 'ਤੇ ਇਹਨਾਂ ਨੂੰ ਜਿਹੜੀ ਮਿੱਟੀ ਦੇ ਬਰਤਨ ਹੁੰਦੇ ਹਨ ਜਿਵੇਂ ਕਿ ਉਹ ਬਹੁਤ ਪੁਰਾਣੇ ਬਰਤਨ ਮਿੱਟੀ ਦੇ ਬਰਤਨ ਘੜੇ ਅਤੇ ਹੋਰ ਮਿਲੇ ਸਨ ਜਿਹੜੇ ਪੁਸ਼ਟੀ ਹੁੰਦੀ ਜਿਸ 'ਚ ਗੁਪਤ ਵੰਸ਼ ਆਪਣਾ ਪੰਜਾਬ ਵਿੱਚ ਬਹੁਤ ਟਾਈਮ ਪਹਿਲਾਂ ਪਹਿਲਾਂ ਆ ਗਿਆ ਸੀ ਇਸ ਲਈ ਜਿਹੜਾ ਗੁਪਤ ਗੁਪਤ ਵੰਸ਼ ਹੈ ਇਸਦੇ ਹੋਰ ਕਈ ਮਹੱਤਵ ਉਪ ਉਪਲੱਬਧੀਆਂ ਹਨ ਇਸ ਨੇ ਕਈ ਥਾਵਾਂ 'ਤੇ ਨਿਰਮਾਣ ਕੀਤਾ ਜਿਸ ਵਿੱਚ ਇਸਦਾ ਜਿਹੜਾ ਰਾਜਾ ਗੁਪਤ ਵੰਸ਼ ਦਾ ਰਾਜਾ ਹੈ ਉਹ ਮਹੱਤਪੂਰਨ ਕਿਸੇ ਨੇ ਕਈ ਜੰਗਾ ਵੀ ਜੰਗਾਂ ਵੀ ਕਰੀਆਂ ਜਿਹਨਾਂ ਵਿੱਚ ਉਪਲੱਬਧੀ ਇਸਨੇ ਹਾਸਿਲ ਕੀਤੀ ਕਾਫੀ ਉਪਲੱਬਧੀ ਹਾਸਿਲ ਕੀਤੀ ਆ ਇਸ ਲਈ ਜਿਹੜਾ ਗੁਪਤ ਵੰਸ਼ ਦਾ ਹੈ ਇਸਦੀ ਖੁਸ਼ਹਾਲੀ ਨਾਲ ਪੰਜਾਬ ਨੂੰ ਇੱਕ ਬਹੁਤ ਹੀ ਤਰੱਕੀ ਦਾ ਸ਼ਾਸਨ ਮਿਲਿਆ ਹੈ ਇਸ ਦੇ ਰਾਜ ਵਿੱਚ ਪੰਜਾਬ ਨੇ ਅੱਛੀ ਤਰੱਕੀ ਕੀਤੀ ਹੈ ਇਸ ਲਈ ਉ ਗੁਪਤ ਵਸ਼ ਗੁਪਤ ਵੰਸ਼ ਹੈ ਉਹ ਖੁਸ਼ਹਾਲੀ ਦੇ ਇੱਕ ਪ੍ਰਤੀਕ ਮੰਨਿਆ ਗਿਆ ਹੈ